ਜਿਵੇਂ ਕਿ ਸਾਨੂੰ ਪਤਾ ਵੀ ਜੀਵਤ ਰਹਿਣ ਲਈ ਸਾਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਹੋਰ ਗ੍ਰਹਿਆਂ ਦੇ ਉੱਪਰ ਇਹਦੇ ਹਾਲੇ ਹੋਰ ਕੋਈ ਸੰਕੇਤ ਨਹੀਂ ਮਿਲੇ ਹੈਗੇ ਇਸ ਲਈ ਹੋਰ ਗ੍ਰਹਿਆਂ ਦੇ ਉੱਪਰ ਹਾਲੇ ਹੋਰ ਜੀਵਨ ਸੰਭਵ ਨਹੀਂ ਹੈ ਪਰ ਚੰਦ ਦੇ ਉੱਪਰ ਪਾਣੀ ਦੇ ਸੰਕੇਤ ਮਿਲੇ ਨੇ ਇਸ ਕਰਕੇ ਵਿਗਿਆਨੀਆਂ ਨੂੰ ਇਹ ਲੱਗਦਾ ਵੀ ਵਿਗਿਆਨੀਆਂ ਨੂੰ ਇਸਦੀ ਖੋਜ ਕੀਤੀ ਆ ਵੀ ਚੰਦਰ ਚੰਦ ਦੇ ਉੱਪਰ ਹੀ ਜੀਵਨ ਸੰਭਵ ਹੈ ਹੋਰ ਗ੍ਰਹਿਆਂ ਦੇ ਪਰ ਹਾਲੇ ਖੋਜ ਚੱਲ ਰਹੀ ਹੈ